ਮੇਰਾ ਨਾਮ ਰਾਕੇਸ਼ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਜੇ ਮੈਂ ਗੱਲ ਕਰਾਂ ਤਾਂ ਸਾਡੇ ਖੇਤਰ ਨੂੰ ਚਲਾਉਣ ਵਾਲੀਆਂ ਮੁੱਖ ਸਿਆਸੀ ਪਾਰਟੀਆਂ ਕਿਹੜੀਆਂ ਹਨ ਵੈਸੇ ਜੇ ਮੈਂ ਗੱਲ ਕਰਾਂ ਤਾਂ ਸਾਡੇ ਇੱਥੇ ਕਾਫੀ ਸਿਆਸੀ ਪਾਰਟੀਆਂ ਹਨ ਜੋ ਆਪਣੇ ਆਪਣੇ ਪੱਧਰ 'ਤੇ ਸਾਡੇ ਲਈ ਚੰਗੇ ਕੰਮ ਕਰਦੀਆਂ ਹਨ ਅਤੇ ਇਹਨਾਂ ਵਿੱਚੋਂ ਕੁਝ ਪਾਰਟੀਆਂ ਹਨ ਜਿਵੇਂ ਕਿ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਅਤੇ ਹੋਰ ਕਈ ਪਾਰਟੀਆਂ ਹਨ ਕਈ ਉਮੀਦਵਾਰ ਸਾਡੇ ਖੇਤਰ ਵਿੱਚ ਆਜ਼ਾਦ ਵੀ ਚੋਣਾਂ ਲੜਦੇ ਹਨ ਇੱਕ ਪਾਰਟੀ ਦੇ ਮੈਂਬਰ ਆਪਣੇ ਆਪਣੇ ਪੱਧਰ 'ਤੇ ਸਾਡੇ ਖੇਤਰ ਨੂੰ ਹੋਰ ਬਿਹਤਰ ਬਣਉਣ ਲਈ ਬਹੁਤ ਵਧੀਆ ਵਧੀਆ ਕੰਮ ਕਰਦੇ ਹਨ ਜਿਸ ਨਾਲ ਸਾਨੂੰ ਕਾਫੀ ਸਹੂਲਤਾਂ ਮਿਲਦੀਆਂ ਹਨ ਜਿਵੇਂ ਕਿ ਹਰ ਵਾਰ ਜਦੋਂ ਵੀ ਕੋਈ ਨਵੀਂ ਪਾਰਟੀ ਦਾ ਮੈਂਬਰ ਜਿੱਤਦਾ ਹੈ ਤਾਂ ਉਹ ਵੱਖ ਵੱਖ ਕੰਮ ਕਰਦਾ ਹੈ ਜਿਵੇਂ ਸਕੂਲਾਂ ਨੂੰ ਹੋਰ ਬਿਹਤਰ ਬਣਾਇਆ ਜਾਂਦਾ ਹੈ ਸੜਕਾਂ ਨੂੰ ਹੋਰ ਵਧੀਆ ਬਣਾਇਆ ਜਾਂਦਾ ਹੈ ਹੋਸਪਿਟਲਾਂ ਵਿੱਚ ਵੱਖ ਵੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਦਵਾਈ ਵਗੈਰਾ ਮੁਫਤ ਦਿੱਤੀ ਜਾਂਦੀ ਹੈ ਅਤੇ ਪਿਛੜੇ ਹੋਏ ਜਿਹੜੇ ਖੇਤਰ ਹਨ ਉਹਨਾਂ ਨੂੰ ਵਧੀਆ ਬਣਾਉਣ ਲਈ ਉੱਚ ਕਦਮ ਚੁੱਕੇ ਜਾਂਦੇ ਹਨ ਪਿਛਲੇ ਇਤਿਹਾਸ ਦੀ ਗੱਲ ਕਰੀਏ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਇੱਥੇ ਬਹੁਤ ਵਧੀਆ ਵਧੀਆ ਕੰਮ ਕੀਤੇ ਹਨ ਅਤੇ ਉਹਨਾਂ ਦੇ ਮਾਰਗਦਰਸ਼ਕ ਦੇ ਨਾਲ ਹੀ ਸਾਡੀਆਂ ਜਿਹੜੀਆਂ ਨਵੀਆਂ ਪਾਰਟੀਆਂ ਹਨ ਹੋਰ ਵਧੀਆ ਵਧੀਆ ਕੰਮ ਕਰ ਰਹੀਆਂ ਹਨ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜਿਵੇਂ ਕਿ ਉਹਨਾਂ ਨੇ ਇੱਕ ਕਲੀਨਿਕ ਸਿਵਲ ਮੁਹੱਲਾ ਕਲੀਨਿਕ ਸੁਵਿਧਾ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਜੋ ਗਰੀਬ ਲੋਕ ਹਨ ਬੜੇ ਵਧੀਆ ਢੰਗ ਦੇ ਨਾਲ ਆਪਣੀ ਦਵਾਈ ਵਗੈਰਾ ਉੱਥੋਂ ਲੈ ਸਕਦੇ ਹਨ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਛੋਟੀਆਂ ਛੋਟੀਆਂ ਸੁਵਿਧਾਵਾਂ ਆਪਣੀ ਜਨਸੰਖਿਆ ਨੂੰ ਆਪਣੇ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਹਨ ਧੰਨਵਾਦ